ਮੈਂ ਘੁੰਮਣ ਫਿਰਨ ਦਾ ਸ਼ੋਕ ਸ਼ੌਂਕ ਰੱਖਦਾ ਹਾਂ ਯਾਤਰਾ 'ਤੇ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਲਈ ਜਾਂਦਾ ਅਤੇ ਐਤਕੀ ਮੈਂ ਸ਼੍ਰੀ ਅਨੰਦਪੁਰ ਸਾਹਿਬ ਯਾਤਰਾ 'ਤੇ ਆਪਣੇ ਪਰਿਵਾਰ ਸਮੇਤ ਗਿਆ ਸੀ ਤਾਂ ਉੱਥੇ ਹੋਲਾ ਮਹੱਲੇ 'ਤੇ ਗਏ ਸੀ ਉੱਥੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਸੀ ਤਾਂ ਨੂੰ ਸ਼੍ਰੀ ਦਰਬਾਰ ਸਾਹਿਬ 'ਤੇ ਮੱਥਾ ਟੇਕਣ ਲਈ ਵੀ ਬਹੁਤ ਹੀ ਲਾਇਨ 'ਚ ਲੱਗ ਕੇ ਮੱਥਾ ਟੇਕਣਾ ਪਿਆ ਉਹ ਤੋਂ ਬਾਅਦ ਜਦੋਂ ਬਾਹਰ ਆਏ ਉਸ ਤੋਂ ਬਾਅਦ ਸਿੰਘ ਆਪਣੇ ਜੌਹਰ ਦਿਖਾ ਰਹੇ ਸੀ ਘੋੜਿਆਂ 'ਤੇ ਅਤੇ ਤੰਬੂ ਗੱਡੀ ਬੈਠੇ ਸੀ ਅਤੇ ਬਹੁਤ ਭੀੜ ਸੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਦੇ ਜੌਹਰ ਵੀ ਦੇਖਣੇ ਸਨ ਅਤੇ ਮਾਨਸਿਕ ਧ ਦੇ ਦੇ ਨਾਲ ਨਾਲ ਸਰੀਰਕ ਤੌਰ 'ਤੇ ਤਲਵਾਰਬਾਜੀ ਦੇ ਲਈ ਪ੍ਰੇਰਿਤ ਕਾ ਕੀਤਾ ਸੀ ਅਤੇ ਲੋਕਾਂ ਦੀ ਹੋਲੀ ਅਤੇ ਖਾਲਸੇ ਦਾ ਹੋਲਾ ਫਿਰ ਵਿਸਾਖੀ ਵਾਲੇ ਦਿਨ ਸਿੱਖ ਪੰਥ ਦੀ ਸਥਾਪਨਾ ਵੀ ਕੀਤੀ ਸੀ ਅਤੇ ਇੱਥੇ ਦੇਖਣਯੋਗ ਹੈ ਕਿ ਸਿੱਖ ਵਿਰਾਸਤਾ ਖਾਲਸਾ ਹੈ ਸੇ ਸਿ ਸਿੱਖ ਇਤਿਹਾਸਿਕ ਅਤੇ ਪੰਜਾਬੀ ਸੱਭਿਅਤਾ ਨੂੰ ਪ੍ਰੇਰਿਤ ਕਰਦਾ ਹੈ ਯਾਤਰਾ ਕਰਕੇ ਮੈਨੂੰ ਬਹੁਤ ਵਧੀਆ ਅਤੇ ਪ੍ਰੇਰਨਾ ਕ ਮਿਲੀ